ਯੋਗਾ ਕਰਨ ਨਾਲ ਸਾਡਾ ਮਨ ਸ਼ਾਂਤ ਹੁੰਦਾ ਹੈ ਅਤੇ ਸਾਡੀ ਸਿਹਤ ਵੀ ਚੰਗੀ ਰਹਿੰਦੀ ਹੈ ਯੋਗਾ ਬਹੁਤ ਸਾਰੀ ਚੀਜ਼ਾਂ ਨਾਲ ਮਿਲੀਆਂ ਹੋਈਆਂ ਹਨ ਯੋਗਾ ਕਰਨ ਨਾਲ ਕਸਰਤ ਨਾਲ ਵੀ ਜੋੜਿਆ ਗਿਆ ਹੈ ਜਾਂ ਫਿਰ ਗਤੀਸ਼ੀਲਤਾ ਰੂਪੀ ਖੇਡਾਂ ਨਾਲ ਵੀ ਜੋੜਿਆ ਗਿਆ ਹੈ ਯੋਗਾ ਕਰਨ ਨਾਲ ਹਰ ਇਨਸਾਨ ਤੰਦਰੁਸਤ ਰਹਿੰਦਾ ਹੈ ਅਤੇ ਜਾਂ ਕਸਰਤ ਕਰਨ ਦੇ ਨਾਲ ਵੀ ਲੋਕ ਆਪਣੇ ਆਪ ਦੀ ਸਿਹਤ ਨੂੰ ਵਧੀਆ ਕਰ ਲੈਂਦੇ ਹਨ ਯੋਗਾ ਵਿੱਚ ਕਈ ਤਰ੍ਹਾਂ ਦੀਆਂ ਐਕਸਰਸਾਈਜ਼ਾਂ ਹੁੰਦੀਆਂ ਹਨ ਜੋ ਲੋਕ ਕਰਦੇ ਹਨ ਅਤੇ ਆਪਣੇ ਸਰੀਰ ਨੂੰ ਔਰ ਵਧੀਆ ਬਣਾਉਂਦੇ ਹਨ ਜਾਂ ਤੁਸੀਂ ਕਾਰਡੀਓ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਵੈਸ਼ਟ ਲਗਾ ਸਕਦੇ ਹੋ ਜੇ ਖੇਡਾਂ ਵਿੱਚ ਆਪਣੀ ਵ ਆਪਣੀ ਵਰਤੋਂ ਵੀ ਵਧਾ ਸਕਦੇ ਹਾਂ ਖੇਡਾਂ ਵੀ ਇੱਕ ਤਰ੍ਹਾਂ ਦੀ ਯੋਗਾ ਹੀ ਹੈਗੀ ਹੈ ਜੋ ਲੋਕਾਂ ਦੇ ਸਰੀਰਾਂ ਨੂੰ ਅੱ ਵਧੀਆ ਬਣਾਉਂਦੀਆਂ ਹਨ ਅਤੇ ਉਹਨਾਂ ਨੂੰ ਮੋਟਾਪਾ ਜਾਂ ਫਿਰ ਸ਼ੂਗਰ ਦੇ ਨਾਲ ਹੋਣ ਵਾਲੀ ਬਿਮਾਰੀਆਂ ਤੋਂ ਦੂਰ ਰੱਖਦੀਆਂ ਹਨ ਯੋਗਾ ਕਰਨ ਦੇ ਨਾਲ ਨਾਲ ਆਪਾਂ ਆਪਣੇ ਸਰੀਰ ਨੂੰ ਕਰਦੇ ਹਨ ਅਤੇ ਆਪਣੇ ਸਰੀਰ ਦੇ ਨਾਲ ਨਾਲ ਜੁੜੀਆਂ ਗਈਆਂ ਬਿਮਾਰੀਆਂ ਨੂੰ ਦੂਰ ਰੱਖਦੇ ਹਨ ਲੋਕ ਯੋਗਾ ਦੇ ਨਾਲ ਨਾਲ ਖੇਡਾਂ ਵੀ ਖੇਡਦੇ ਹਨ ਅਤੇ ਉਹ ਖੇਡਣ ਦੇ ਨਾਲ ਉਹਨਾਂ ਦੇ ਅੰਦਰ ਜਿਹੜੀ ਭਾਵਨਾ ਆਉਂਦੀ ਹੈ ਅਤੇ ਉਹ ਭਾਵਨਾ ਉਹਨਾਂ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਯੋਗਾ ਇੱਕ ਉਹ ਕਲਾ ਹੈਗੀ ਹੈ ਜਿਹਨੂੰ ਕਰਨ ਦੇ ਨਾਲ ਲੋਕ ਬਹੁਤ ਜ਼ਿਆਦਾ ਆਨੰਦ ਪ੍ਰਾਪਤ ਕਰਦੇ ਹਨ ਇਹ ਅਭਿਆਸ ਰੋਜ਼ਾਨਾ ਕਰਦਾ ਜਾਂਦਾ ਹੈ ਇਹ ਅਭਿਆਸ ਕਰਨ ਨਾਲ ਤੁਸੀਂ ਖੇਡਾਂ ਵਿੱਚ ਵੀ ਆਪਣੀ ਮਹੱਤਤਾ ਵਧਾ ਸਕਦੇ ਹੋ ਅਗਰ ਤੁਹਾਡਾ ਸਰੀਰ ਹੀ ਵਧੀਆ ਹੋਏਗਾ ਤਾਂ ਹੀ ਤੁਸੀਂ ਖੇਡਾਂ ਨੂੰ ਖੇਡਾਂ ਵਾਂਗ ਖੇਡ ਸਕਦੇ ਹੋ ਜੇਕਰ ਸਰੀਰ ਹੀ ਨਿਕੰਮਾ ਹੋਵੇਗਾ ਤਾਂ ਤੁਸੀਂ ਖੇਡਾਂ ਨੂੰ ਖੇਡਾਂ ਵਾਂਗੂ ਨਹੀਂ ਖੇਡ ਸਕਦੇ ਖੇਡਾਂ ਵਿੱਚ ਵੀ ਆਪਣੇ ਸਰੀਰਕ ਤਾਕਤ ਹੀ ਲੱਗਦੀ ਹੈ ਅਤੇ ਉਹ ਤਾਕਤ ਤੁਹਾਨੂੰ ਯੋਗਾ ਕਰਨ ਦੇ ਨਾਲ ਮਿਲਦੀ ਹੈ ਅਤੇ ਸਹੀ ਭੋਜਨ ਕਰਨ ਨਾਲ ਮਿਲਦੀ ਹੈ ਯੋਗਾ ਕਰਨ ਨਾਲ ਤੁਸੀਂ ਆਪਣੀ ਸਿਹਤ ਨੂੰ ਦੇਖਭਾਲ ਕਰ ਸਕਦੇ ਹੋ ਤੁਸੀਂ ਇਹ ਦੇਖਭਾਲ ਦੂਜੇ ਲੋਕਾਂ ਨੂੰ ਵੀ ਕਹਿ ਸਕਦੇ ਹੋ ਕਿ ਅਗਰ ਤੁਸੀਂ ਆਪਣੀ ਚੀਜ਼ਾਂ ਨੂੰ ਸੰਭਾਲ ਕੇ ਰੱਖਣਾ ਚਾਹੁੰਦੇ ਹੋ ਆਪਣੇ ਸਰੀਰ ਨੂੰ ਤਾਂ ਯੋਗਾ ਕਰਨੀ ਚਾਹੀਦੀ ਹੈ ਧੰਨਵਾਦ